ਜਾਤ ਵਿੱਚ ਮੁੱਖ ਸਮਾਜਿਕ ਅਤੇ ਸੱਭਿਆਚਾਰਕ ਸਮੂਹ ਬਹੁਤ ਸਾਰੇ ਹਨ ਇਨ੍ਹਾਂ ਵਿੱਚ ਜਾਤ ਵਰਗ ਨਸਲ ਭਾਸ਼ਾ ਧਰਮ ਵੰਡ ਸਕਦੇ ਹਨ ਜਿਵੇਂ ਕਿ ਜਾਤ ਜੱਟ ਸੈਣੀ ਹਰੀਜਨ ਤਰਖਾਣ ਬਾਜ਼ੀਗਰ ਲਵਾਣੇ ਆਦਿ ਹਨ ਅਤੇ ਜੇਕਰ ਅਸੀਂ ਭਾਸ਼ਾ ਦੀ ਗੱਲ ਕਰੀਏ ਸਾਡੀ ਭਾਸ਼ਾ ਜ਼ਿਆਦਾ ਕਰਕੇ ਪੰਜਾਬ ਵਿੱਚ ਪੰਜਾਬੀ ਹਿੰਦੀ ਹੀ ਵਰਤੀ ਜਾਂਦੀ ਹੈ ਹਿੰਦੀ ਵੀ ਤਾਂ ਵਰਤੀ ਜਾਂਦੀ ਹੈ ਕਿ ਇੱਥੇ ਜ਼ਿਆਦਾ ਕਰਕੇ ਪ੍ਰਵਾਸੀ ਲੋਕ ਰਹਿੰਦੇ ਹਨ ਤਾਂ ਕਰਕੇ ਸਾਨੂੰ ਹਿੰਦੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਫਿਰ ਅਸੀਂ ਧਰਮ ਦੀ ਗੱਲ ਕਰੀਏ ਸਿੱਖ ਹਿੰਦੂ ਮੁਸਲਿਮ ਆਦਿ ਅਸੀਂ ਰਹਿੰਦੇ ਹਨ ਅਸੀਂ ਸਾਰੇ ਜਣੇ ਬਹੁਤ ਮਿਲ ਜੁਲ ਕੇ ਤਿਓਹਾਰ ਆਦਿ ਵੀ ਮਨਾਉਂਦੇ ਹਨ ਅਤੇ ਸਾਡੇ ਸਾਰੀਆਂ ਜਾਤਾਂ ਦਾ ਬਹੁਤ ਜ਼ਿਆਦਾ ਪਿਆਰ ਵੀ ਹੈ ਠੀਕ ਹੈ